ਮੇਰਾ ਨਾਂ ਭਾਰਤ ਭੂਸ਼ਣ ਪਿੰਡ ਮਿਰਜਾਪੁਰ ਜ਼ਿਲ੍ਹਾ ਪਠਾਨਕੋਟ ਦਾ ਰਹਿਣ ਵਾਲਾ ਪਠਾਨਕੋਟ ਦੀ ਗੱਲ ਕਰੀਏ ਤਾਂ ਪਠਾਨਕੋਟ 'ਚ ਰਿਹਾਇਸ਼ ਲਈ ਜਗ੍ਹਾ ਜਿੱਦਾਂ ਕਿ ਮਹਾਰਾਜਾ ਰਣਜੀਤ ਸਿੰਘ ਦੇ ਟਾਇਮ ਦੀ ਜਗ੍ਹਾ ਜਿਹਦੇ ਵਿੱਚ ਮਾਧੋਪੁਰ ਦੇ ਵਿੱਚ ਉਨ੍ਹਾਂ ਨੇ ਆਪਣਾ ਅਸਤਬਲ ਜਾਨੀ ਕਿ ਘੋੜਿਆਂ ਨੂੰ ਰੱਖਣ ਦਾ ਇੱਕ ਸਥਾਨ ਬਣਿਆ ਸੀ ਉੱਥੇ ਅੱਜ ਕੱਲ੍ਹ ਇੰਜਨੀਰਿੰਗ ਯਾਨੀ ਕਿ ਵਰਕਸ਼ੋਪ ਹੈ ਅਤੇ ਜੇਕਰ ਗੱਲ ਕਰੀਏ ਪਠਾਨਕੋਟ ਪਠਾਨਕੋਟ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਕਾਫ਼ੀ ਟਾਇਮ ਤੱਕ ਰਹੇ ਮਾਧੋਪੁਰ ਹੈੱਡ ਦੇ ਵਿੱਚ ਉਨ੍ਹਾਂ ਨੇ ਆਪਣਾ ਰਹਿਣ ਵਾਸਤੇ ਘਰ ਵੀ ਬਣਾਇਆ ਹੋਇਆ ਸੀ ਅਤੇ ਕਾਫ਼ੀ ਟਾਇਮ ਉਨ੍ਹਾਂ ਨੇ ਮਾਧੋਪੁਰ ਜਾਂ ਪਠਾਨਕੋਟ ਦੇ ਵਿੱਚ ਰਹੇ ਉਨ੍ਹਾਂ ਦੇ ਨਾਲ ਦੇ ਨਾਲ ਉਨ੍ਹਾਂ ਦੇ ਸਾਹਪੁਰ ਕੰਢੀ ਇੱਕ ਡੈਮ ਦੀ ਉਸਾਰੀ ਵੀ ਕੀਤੀ ਉਨਾਂ ਉਸ ਦਾ ਨਾਮ ਵੀ ਉਹਨਾਂ ਨੇ ਆਪਣੇ ਨਾਂ 'ਤੇ ਯਾਨੀ ਕਿ ਮਹਾਰਾਜਾ ਰਣਜੀਤ ਸਿੰਘ ਦੇ ਨਾਂ 'ਤੇ ਰੱਖਿਆ ਸੀ ਮਹਾਰਾਜਾ ਰਣਜੀਤ ਸਿੰਘ ਦੇ ਨਾਂ 'ਤੇ ਰੱਖਿਆ ਸੀ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਜਿਹੜਾ ਬਣਿਆ ਡੈਮ ਹੈ ਉਹ ਅੱਗੇ ਆ ਕੇ ਰਾਵੀ ਦਰਿਆ ਨਾਲ ਮਿਲਦਾ ਹੈ ਰਾਵੀ ਦਰਿਆ ਦੇ ਵਿੱਚ ਇੱਕ ਯੁਗਿਆਲ ਦੇ ਲਾਗੇ ਇਕ ਪਿੰਡ ਹੈ ਡੂੰਗ ਪਿੰਡ ਡੂੰਗ ਪਿੰਡ ਦੇ ਵਿੱਚ ਇੱਕ ਧਾਰਮਿਕ ਜਗ੍ਹਾ ਹੈ ਜਿਸ ਦਾ ਨਾਂ ਮੁਕੇਸ਼ਵਰ ਧਾਮ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਮੁਕੇਸ਼ਵਰ ਧਾਮ ਯਾਨੀ ਕਿ ਉਹਦੇ ਵਿੱਚ ਪੰਜੇ ਪਾਂਡਵ ਲਗਪਗ ਦੋ ਸਾਲ ਲਈ ਜਾਂ ਦੋ ਆਪਣੇ ਬਣਵਾਸ 'ਤੇ ਨਿਕਲੇ ਸੀ ਅਤੇ ਉਹ ਉੱਥੇ ਰਹੇ ਸੀ ਲੁੱਕ ਕੇ ਰਹੇ ਸੀ ਉਹ ਜਗ੍ਹਾ ਅੱਜ ਕੱਲ੍ਹ ਪਵਿੱਤਰ ਸਥਾਨ ਮੰਨੀ ਜਾਂਦੀ ਹੈ ਅਤੇ ਉਹ ਉਹਨੂੰ ਪੂਜਣਯੋਗ ਅਤੇ ਆਪਣਾ ਸ਼ਿਵਲਿੰਗ ਹੈ ਉਹਨੂੰ ਦੇਖਣ ਵਾਸਤੇ ਕਾਫ਼ੀ ਕਾਫ਼ੀ ਦੂਰ ਦੂਰ ਤੋਂ ਲੋਕ ਆਉਂਦੇ ਨੇ ਧੰਨਵਾਦ ਜੀ